ਮੇਰਾ ਸਭ ਤੋਂ ਉੱਚਾ ਰਿਕਾਰਡ ਦੌੜਨ ਦਾ ਹੈ ਮੈਂ ਅਕਸਰ ਹੀ ਸਵੇਰ ਦੀ ਸੈਰ ਕਰਦਾ ਹਾਂ ਅਤੇ ਥੋੜ੍ਹੀ ਤੇਜ਼ ਗਤੀ ਨਾਲ ਚੱਲਦਾ ਹਾਂ ਜਾਂ ਤੁਸੀਂ ਹਲਕੀ ਦੌੜ ਵੀ ਕਹਿ ਸਕਦੇ ਹੋ ਮੈਂ ਇੱਕ ਵਾਰ ਵਿੱਚ ਸੱਤ ਕਿਲੋਮੀਟਰ ਤੱਕ ਦੀ ਹਲਕੀ ਚਾਲ ਨਾਲ ਸੈਰ ਕਰ ਚੁੱਕਿਆ ਹਾਂ ਇਹ ਮੇਰਾ ਸਭ ਤੋਂ ਉੱਚਾ ਅਤੇ ਵੱਡਾ ਰਿਕਾਰਡ ਹੈ ਉਂਝ ਮੈਂ ਹਰ ਰੋਜ਼ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਦੌੜਦਾ ਹਾਂ ਮੈਂ ਸਵੇਰ ਵੇਲੇ ਸਦੇਹਾਂ ਉੱਠ ਕੇ ਸੈਰ ਕਰਨ ਜਾਂਦਾ ਹਾਂ ਥੋੜ੍ਹੀ ਦੇਰ ਤੱਕ ਤੁਰਨ ਤੋਂ ਬਾਅਦ ਮੈਂ ਹਲਕੀ ਦੌੜ ਲਗਾਉਂਦੇ ਹੋਏ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਦਾ ਸਫਰ ਤੈਅ ਕਰਦਾ ਹਾਂ ਇਸ ਤੋਂ ਬਿਨਾ ਮੇਰੇ ਟੀਚੇ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਅਤੇ ਨਾਲ ਆਪਣੇ ਪਰਿਵਾਰ ਨੂੰ ਵੀ ਸਿਹਤਮੰਦ ਰੱਖਣਾ ਹੈ ਇਸ ਲਈ ਮੈਂ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਓਨੀ ਕੋਸ਼ਿਸ਼ ਕਰਦਾ ਹਾਂ ਮੈਂ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ ਨੂੰ ਵੀ ਚੰਗੀ ਅਤੇ ਨਰੋਈ ਸਿਹਤ ਰੱਖਣ ਲਈ ਪ੍ਰੇਰਿਤ ਕਰਦਾ ਹਾਂ ਆਪਣੇ ਪਰਿਵਾਰ ਦੇ ਮੈਂਬਰਾਂ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਦਾ ਹਾਂ ਮੇਰਾ ਟੀਚਾ ਹੈ ਕਿ ਕੋਈ ਵੀ ਅਜਿਹਾ ਭੋਜਨ ਨਾ ਕੀਤਾ ਜਾਵੇ ਜੋ ਸਾਨੂੰ ਬਿਮਾਰ ਕਰ ਸਕਦਾ ਹੈ